ਨਾਗਰਿਕਾਂ ਦੀ ਸੁਰੱਖਿਆ ਅਤੇ ਸਮਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕਾਨੂੰਨ ਪ੍ਰਣਾਲੀ ਵਿੱਚ ਹਾਲੇ ਵੀ ਬਹੁਤ ਸਾਰੇ ਸੁਧਾਰਾਂ ਦੀ ਜ਼ਰੂਰਤ ਹੈ ਦੇਸ਼ ਵਿੱਚ ਵੱਧ ਰਹੇ ਅਪਰਾਧ ਜਿਹੜੇ ਹਨ ਉਹ ਬੇਰੁਜ਼ਗਾਰੀ ਦਾ ਕਾਰਨ ਹੈ ਕਿਉਂਕਿ ਬੇਰੁਜ਼ਗਾਰੀ ਜਿਹੜੀ ਹੈ ਉਹ ਗਰੀਬੀ ਅਤੇ ਅਪਰਾਧ ਨੂੰ ਸੱਦਾ ਦਿੰਦੀ ਹੈ ਜੇਕਰ ਅਪਰਾਧ ਜਿਹੜੇ ਹਨ ਜੋ ਬੱਚਿਆਂ ਦੁਆਰਾ ਕੀਤੇ ਜਾਂਦੇ ਹਨ ਅਤੇ ਉਹ ਉਹਨਾਂ ਦੀ ਜ਼ਰੂਰਤ ਨੂੰ ਲੈ ਕੇ ਕੀਤੇ ਜਾਂਦੇ ਹਨ ਮੇਰੇ ਅਨੁਸਾਰ ਜੇਕਰ ਬੇਰੁਜ਼ਗਾਰੀ ਨੂੰ ਖਤਮ ਕੀਤਾ ਜਾਏਗਾ ਅਤੇ ਆਪਣੇ ਆਪ ਹੀ ਸਾਰੇ ਸਮਾਜ ਦੇ ਵਿੱਚ ਸ਼ਾਂਤੀ ਬਣ ਜਾਵੇਗੀ ਕਿਉਂਕਿ ਲੋਕ ਚੋਰੀ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਕਰਕੇ ਕਰਦੇ ਹਨ ਔਰ ਇਹ ਅਪਰਾਧ ਜਿਹੜੇ ਹਨ ਇਹ ਇਸ ਚੀਜ਼ ਦਾ ਸਾਡੇ ਕੋਲ ਇੱਕ ਸਿੱਟਾ ਨਿਕਲ ਕੇ ਆਉਂਦਾ ਹੈ ਲੱਗਦਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਪੁਲਿਸ 'ਚ ਭਰਤੀ ਕਰਨਾ ਚਾਹੀਦਾ ਹੈ ਜਿਹਦੇ ਨਾਲ ਸੁਰੱਖਿਆ ਵੀ ਵਧੇਗੀ ਔਰ ਬੇਰੁਜ਼ਗਾਰੀ ਵੀ ਘੱਟੇਗੀ